ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਕਲਾ ਹਨ ਇੱਥੇ ਵੱਖ ਵੱਖ ਸ਼ਹਿਰਾਂ ਤੋਂ ਲੋਕ ਆ ਕੇ ਵੱਸਦੇ ਹਨ ਇੱਥੇ ਸਿਲਾਈ ਅਤੇ ਕਢਾਈ ਬਹੁਤ ਹੀ ਜ਼ਿਆਦਾ ਪ੍ਰਚਲਿਤ ਹੈ ਜ਼ਿਆਦਾਤਰ ਲੋਕ ਇੱਥੇ ਸੱਭਿਆਚਾਰਕ ਮਹੱਤਤਾ ਦਿੰਦੇ ਹਨ ਜਿਵੇਂ ਕਿ ਗਿੱਧਾ ਭੰਗੜਾ ਇਸ ਚੀਜ਼ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਨੌਜਵਾਨ ਮੁੰਡੇ ਕੁੜੀਆਂ ਹਰ ਪੱਧਰ ਉੱਤੇ ਭੰਗੜਾ ਗਿੱਧਾ ਕਰਦੇ ਹਨ ਆਪਣੇ ਕਾਲਜ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਭੰਗੜਾ ਗਿੱਧਾ ਕਰਕੇ ਬਹੁਤ ਹੀ ਜ਼ਿਆਦਾ ਨਾਮ ਕਮਾ ਰਹੇ ਹਨ ਇਸ ਤੋਂ ਇਲਾਵਾ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਵੀ ਪਿੰਡਾਂ ਦੀਆਂ ਔਰਤਾਂ ਆਪਣੇ ਵਿਹਲੇ ਸਮੇਂ ਵਿੱਚ ਸਿਲਾਈ ਕਰਦੀਆਂ ਹਨ ਫੁਲਕਾਰੀ ਦੀਆਂ ਕਢਾਈਆਂ ਕਰਦੀਆਂ ਹਨ ਜੁੱਤੀਆਂ 'ਤੇ ਕਢਾਈਆਂ ਕਰਦੀਆਂ ਹਨ ਇਸ ਨਾਲ ਉਨ੍ਹਾਂ ਦੇ ਆਮਦਨ ਦਾ ਵੀ ਸਾਧਨ ਬਣ ਜਾਂਦਾ ਹੈ ਅਤੇ ਉਹ ਪੰਜਾਬੀ ਸੱਭਿਆਚਾਰ ਨੂੰ ਵੀ ਸੰਭਾਲ ਰਹੀਆਂ ਹਨ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਪਰ ਇਸ ਪਿੰਡਾਂ ਦੀ ਔਰਤਾਂ ਦੇ ਇਸ ਸਾਥ ਨਾਲ ਜਿਹੜਾ ਕਿ ਸੱਭਿਆਚਾਰ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਅੱਗੇ ਹੁਲਾਰਾ ਮਿਲ ਰਿਹਾ ਹੈ